ਹਾਂਜੀ ਇਹ ਆਪਣੇ ਹਿਲਟਨ ਹੋਟਲ ਤੋਂ ਬੋਲ ਰਹੇ ਹੋ ਫਿਰੋਜ਼ਪੁਰ ਦੇ ਹਾਂਜੀ ਸਰ ਮੈਂ ਆਪਣੇ ਇੱਥੇ ਇੰਜਨੀਅਰਿੰਗ ਕਾਲੇਜ ਸੈਂਟਰਲ ਇੰਜੀਨੀਅਰਿੰਗ ਕਾਲੇਜ ਤੋਂ ਬੋਲ ਰਿਹਾ ਸੀ ਅਤੇ ਬੁਕਿੰਗ ਕਰਵਾਈ ਸੀ ਅਸੀਂ ਵੀਹ ਜਨਵਰੀ ਉਹਦੇ ਵਾਸਤੇ ਆ ਰਹੇ ਸੀ ਤਾਂ ਮੈਂ ਪੁੱਛਣਾ ਸੀ ਕਮਰੇ ਅਲੋਟ ਹੋ ਗਏ ਓ ਉਧਰ ਜਾਂ ਹਜੇ ਟਾਈਮ ਲੱਗੇਗਾ ਉਹਨੂੰ ਤਿੰਨ ਦਿਨ ਦੀ ਬੁਕਿੰਗ ਹੈ ਕੱਲ ਤੋਂ ਲੈ ਕੇ ਅਗਲੇ ਤਿੰਨ ਦਿਨ

ਹਾਂਜੀ ਨਹੀਂ ਨਹੀਂ ਸਰ ਬ੍ਰੇਕ ਬ੍ਰੇਕਫਾਸਟ ਇਨਕਲੂਡ ਕਰਨੇ ਵੀਹ ਲੋਕਾਂ ਦੇ ਅਸੀਂ ਦਸ ਕਮਰੇ ਕੀਤੇ ਸੀ ਅਤੇ ਉਹ ਦੱਸੋ ਦੇ ਦੱਸੋ ਇੱਕੋ ਫਲੋਰ 'ਤੇ ਨੇ ਠੀਕ ਹੈ ਕਿਨਵਾਂ ਕਿੰਨਾ ਨੰਬਰ ਫਲੋਰ ਹੋਵੇਗਾ ਉਹ

ਠੀਕ ਹੈ ਸਰ ਠੀਕ ਹੈ ਅਤੇ ਹਰ ਕਮਰੇ 'ਚ ਦੋ ਬੈਡ ਹੋਣਗੇ ਅੱਛਾ ਠੀਕ ਹੈ ਅਤੇ ਬ੍ਰੇਕਫਾਸਟ ਕਿੰਨੇ ਵਜੇ ਹੋਏਗਾ ਅਵੇਲੇਬਲ ਅਤੇ ਥੱਲੇ ਆਉਣਾ ਪਵੇਗਾ ਸਾਰੇ ਬੱਚਿਆਂ ਨੂੰ ਠੀਕ ਹੈ ਸਰ ਉਦਨ ਜਦੋਂ ਗੱਲ ਕੀਤੀ ਸੀ ਉਦੋਂ ਕਿਹਾ ਸੀ ਕਿ ਡਿਨਰ ਵੀ ਇਨਕਲੂਡਿਡ ਹੋਏਗਾ ਅਤੇ ਉਹਦੇ ਐਕਸਟ੍ਰਾ ਚਾਰਜ ਹੋਣਗੇ ਨਹੀਂ ਸਰ ਇਹ ਤਾਂ ਗਲਤ ਹੈ ਨਾ ਤੁਸੀਂ ਪਹਿਲਾਂ ਜਦੋਂ ਬੁਕਿੰਗ ਕਰਵਾਈ ਸੀ ਉਦੋਂ ਕਿਹਾ ਸੀ ਕਿ ਰੁ ਪਰ ਰੂਮ ਡਿੱਨਰ ਬ੍ਰੇਕਫਾਸਟ ਹੋਵੇਗਾ ਮੈਂ ਬੂਕਿੰਗ ਇਸ ਹੀ ਨੰਬਰ 'ਤੇ ਕੀਤੀ ਸੀ ਹੁਣ ਰਿਸੈਪਸ਼ਨਿਸਟ ਨਾਲ ਹੋਈ ਸੀ ਕਿ ਤੁਹਾਡੇ ਨਾਲ ਹੋਈ ਪਤਾ ਨਹੀਂ ਮੈਨੂੰ ਪਰ ਉਦੋਂ ਉਹਨਾਂ ਨੇ ਕੋਈ ਚਾਰਜ ਨਹੀਂ ਦੱਸੇ ਮੈਨੂੰ ਅੱਛਾ ਫਿਰ ਕੋਈ ਹੁਣ ਜਿਵੇਂ ਬਲਕ ਡਿਸਕਾਊਂਟ ਨਹੀਂ ਮਿਲੇਗਾ ਤੁਸੀਂ ਹਰ ਪਰ ਪਰਸਨ ਸੌ ਕਹਿ ਰਹੇ ਹੋ ਤਾਂ ਵੀਹ ਬੰਦੇ ਹੈ ਹੁਣ ਦੋ ਹਜ਼ਾਰ ਰੁਪਇਆ ਤੁਸੀਂ ਬ੍ਰੇਕਫਾਸਟ ਅਤੇ ਜੀ ਸਰ ਦੇਖ ਲਵਾਂਗੇ ਅੱਛਾ ਚਲੋ ਫਿਰ ਠੀਕ ਹੈ ਲਿਫਟ ਹੋਵੇਗੀ ਨਾ ਸਰ ਕਿਉਂਕਿ ਇਹ ਬੱਚੇ ਸਮਾਨ ਲੈ ਕੇ ਆਉਣਗੇ ਸੈਟਰਡੇ ਦਿਨ ਠੀਕ ਹੈ ਓਕੇ ਠੀਕ ਚਲੋ ਥੈਂਕ ਯੂ ਜੀ